ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਜੇ ਪੰਜਾਬ 'ਚ ਇਹ ਚੀਜ਼ਾਂ ਸਿਖਾਈਆਂ ਜਾਣ ਤਾਂ ਬਹੁਤ ਬਹੁਤ ਡਿਵਲੋਪ ਹੋ ਜਾਣਗੇ ਬੱਚੇ ਆਪਣੇ ਹੁਣ ਘਰ ਆਹ ਪਲੰਬਰਿੰਗ ਦਾ ਹੀ ਕੰਮ ਲਾ ਲਉ ਜੇ ਬੱਚਾ ਇਹ ਸਿੱਖ ਵੀ ਲੈਂਦਾ ਤਾਂ ਬਾਹਰ ਜਾਣ ਦੀ ਉਹਨੂੰ ਲੋੜ ਹੀ ਨਹੀਂ ਉਰੇ ਵੀ ਵਿਹਲਾ ਨਹੀਂ ਰਹਿੰਦਾ ਆਪਣੀ ਰੋਟੀ ਟੁੱਕ ਜੋਗਾ ਤਾ ਕਰੀ ਜਾਊਗਾ ਪਸ਼ੂ ਪਾਲਣ ਕਿੱਡਾ ਵੱਡਾ ਕਿੱਤਾ ਆਪਣਾ ਜਦੋਂ ਕਿ ਇਹਦਾ ਜੱਦੀ ਹੀ ਚੱਲਦਾ ਆ ਰਿਹਾ ਜੱਦਾ ਪੰਜਾਬ ਸ਼ੁਰੂ ਹੋਇਆ ਆਪਣੇ ਪਿੰਡਾਂ 'ਚ ਘਰਾਂ 'ਚ ਆਮ ਹੁੰਦੀਆਂ ਹੀ ਸੀ ਇਹ ਚੀਜ਼ਾਂ ਪਰ ਹੁਣ ਦੇ ਸਮੇਂ ਵਿੱਚ ਬੱਚੇ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਚੀਜ਼ਾਂ ਦਾ ਵੀ ਕੀ ਹੁੰਦੀਆਂ ਨੇ ਕਈ ਬੱਚਿਆਂ ਨੂੰ ਤਾਂ ਪਾਥੀਆਂ ਤੱਕ ਦਾ ਵੀ ਨਹੀਂ ਪਤਾ ਵੀ ਕੀ ਨੇ ਕਿੱਥੋਂ ਬਣਦੀਆਂ ਨੇ ਅਤੇ ਪਸ਼ੂ ਪਾਲਣ ਕਿੱਤੇ 'ਚੋਂ ਕਿੰਨਾ ਕੁਛ ਹੈ ਕਿੰਨੀ ਸਕੋਪ ਆ ਮਿਲਕ ਨਿਕਲ ਆਂਉਂਦਾ ਘੀ ਦੇਸੀ ਮੱਖਣ ਆਪਣਾ ਕਿੰਨਾ ਕੁਛ ਬਣ ਜਾਂਦਾ ਇਹ ਚੀਜ਼ਾਂ ਜੇ ਆਪਾਂ ਹੱਥੀਂ ਕਰੀਏ ਤਾਂ ਇਹ ਚੀਜ਼ਾਂ ਕਿੱਥੇ ਤੱਕ ਆਪਾਂ ਨੂੰ ਲੈ ਕੇ ਜਾ ਸਕਦੀਆਂ ਨੇ ਇਹਨਾਂ ਦੇ ਕਿੱਡੇ ਕਿੱਡੇ ਬਿਜਨਸ ਹੋ ਸਕਦੇ ਨੇ ਕਿਉਂਕਿ ਅੱਜ ਦੇ ਸਮੇਂ ਵਿੱਚ ਪੇਓਰਟੀ ਕਿਤੇ ਵੀ ਨਹੀਂ ਹੈਗੀ ਪੇਓਰ ਚੀਜ਼ ਕਿਤੇ ਵੀ ਨਹੀਂ ਮਿਲਦੀ ਤਾਂ ਆਪਾਂ ਪਸ਼ੂ ਪਾਲਣ ਦੇ ਕਿੱਤੇ 'ਚ ਜੇਕਰ ਇਹ ਚੀਜ਼ਾਂ ਪੇਓਰ ਵੇਚਣ ਲੱਗ ਜਾਈਏ ਤਾਂ ਕਿੰਨਾ ਬਿਜਨਸ ਵਧਿਆ ਆਪਣਾ ਕਿੰਨਾ ਆਪਾਂ ਅੱਗੇ ਵਧੀਏ ਹੋਰ ਵੀ ਕਿੰਨੇ ਸਿਖਲਾਈ ਦੇ ਚੀਜ਼ਾਂ ਨੇ ਜਿਵੇਂ ਆਹ ਪੋਲਟਰੀ ਦਾ ਕੰਮ ਹੋ ਗਿਆ ਇਹ 'ਚ ਵੀ ਕਿੰਨਾ ਕੁਛ ਹੈ ਜਿਹਨੂੰ ਪੋਲੇਟਰੀ 'ਚ ਆਪਾਂ ਲਾ ਲਉ ਇੱਕ ਮੁਰਗੀ ਤੋਂ ਅੰਡਿਆਂ ਦੀ ਹੀ ਕਰੀਏ ਆਪਾਂ ਦੇਸੀ ਅੰਡੇ ਵੀ ਵੇਚੀਏ ਕਿੰਨੇ ਛੇ ਸੱਤ ਰੁਪਏ ਆਪਾਂ ਨੂੰ ਪੈ ਜਾਂਦਾ ਜੇਕਰ ਆਪਾਂ ਉਹ ਘੱਟ ਰੇਟ 'ਚ ਵੇਚਦੇ ਹਾਂ ਤਾਂ ਭੱਜ ਭੱਜ ਲੋਕ ਖਰੀਦਦੇ ਹਨ ਇਹਦੇ ਨਾਲ ਆਪਾਂ ਨੂੰ ਕਿੱਤਾ ਵੀ ਮਿਲ ਜਾਂਦਾ ਦੇਸੀ ਖੁਰਾਕ ਵੀ ਮਿਲ ਜਾਂਦੀ ਹੈ ਸਰੀਰ ਵੀ ਤੰਦਰੁਸਤ ਰਹਿੰਦਾ ਤਾਂ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਆ ਬਹੁਤ ਵਧੀਆ ਗੱਲ ਆ ਜੇ ਇਹ ਚੀਜ਼ਾਂ ਸਿਖਾਈਆਂ ਜਾਣ